ਆਧੁਨਿਕ ਸਮੇਂ ਵਿੱਚ ਪੰਜਾਬੀ ਭਾਸ਼ਾ ਵਿੱਚ ਕਾਫ਼ੀ ਬਦਲਾਂ ਆਏ ਹਨ ਬਾਹਰੋਂ ਆਏ ਲੋਕਾਂ ਦੇ ਰੀਤੀ ਰਿਵਾਜ਼ ਅਤੇ ਧਰਮ ਵੱਖੋ ਵੱਖਰੇ ਹਨ ਜਿਹਨਾਂ ਕਰਕੇ ਪੰਜਾਬੀ ਭਾਸ਼ਾ ਸੱਭਿਆਚਾਰ ਉੱਤੇ ਉਹਨਾਂ ਦਾ ਡੂੰਘਾ ਪ੍ਰਭਾਵ ਪਿਆ ਹੈ ਇਸ ਲਈ ਹੁਣ ਇਸ ਭਾਸ਼ਾ 'ਚ ਕਾਫ਼ੀ ਬਦਲਾਵ ਆ ਚੁੱਕੇ ਹਨ